ਮੈਂ ਆਪਣੇ ਬੁਣਾਈ ਅਤੇ ਸਿਲਾਈ ਪ੍ਰੋਜੈਕਟ ਦੇ ਲਈ ਰੰਗ ਦੀ ਚੋਣ ਉਮਰ ਦੇ ਹਿਸਾਬ ਦੇ ਨਾਲ ਕਰਦੀ ਹਾਂ ਜਿਵੇਂ ਕਿ ਛੋਟੀ ਉਮਰ ਦੇ ਬੱਚਿਆਂ ਦੇ ਲਈ ਗੂੜ੍ਹੇ ਰੰਗ ਬਹੁਤ ਵਧੀਆ ਲੱਗਦੇ ਹਨ ਇਸ ਦੇ ਉਲਟ ਜੇਕਰ ਕੋਈ ਬਜ਼ੁਰਗਾਂ ਦੇ ਲਈ ਸਿਲਾਈ ਜਾਂ ਬੁਣਾਈ ਦਾ ਕੰਮ ਕੀਤਾ ਜਾਂਦਾ ਹੈ ਤਾਂ ਉਸ ਦੇ ਲਈ ਫਿੱਕੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਬਿਨਾ ਜਿੱਦਾਂ ਇੱਕੀ ਤੋਂ ਲੈ ਕੇ ਤੀਹ ਸਾਲ ਦੀ ਉਮਰ ਦੇ ਲਈ ਗੂੜ੍ਹੇ ਰੰਗਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਉਸ ਤੋਂ ਬਾਅਦ ਤੀਹ ਸਾਲ ਤੋਂ ਉੱਪਰ ਚਾਲੀ ਪੰਤਾਲੀ ਸਾਲ ਦੇ ਉਮਰ ਦੇ ਵਿਅਕਤੀਆਂ ਦੇ ਲਈ ਨੌਰਮਲ ਰੰਗ ਹੀ ਵਰਤੇ ਜਾਂਦੇ ਹਨ ਉਨ੍ਹਾਂ ਲਈ ਨਾ ਤਾਂ ਰੰਗ ਬਹੁਤ ਜ਼ਿਆਦਾ ਗੂੜ੍ਹੇ ਵਰਤੇ ਜਾ ਸਕਦੇ ਨੇ ਨਾ ਹੀ ਰੰਗ ਨੇ ਜਿਹੜੇ ਉਸ ਉਹ ਫਿੱਕੇ ਵਰਤੇ ਜਾ ਸਕਦੇ ਹਨ ਇਸ ਤੋਂ ਬਿਨਾ ਜਦੋਂ ਪੰਜਾਹ ਸਾਲ ਤੋਂ ਉੱਪਰ ਦੇ ਵਿਅਕਤੀਆਂ ਦੇ ਲਈ ਕੋਈ ਵੀ ਸਿਲਾਈ ਜਾਂ ਬੁਣਾਈ ਦੇ ਲਈ ਰੰਗ ਚੋਣ ਕਰਨਾ ਹੋਵੇ ਤਾਂ ਉਹਦੇ ਲਈ ਫਿੱਕੇ ਰੰਗ ਹੀ ਵਰਤੇ ਜਾਂਦੇ ਹਨ ਉਸ ਤੋਂ ਬਿਨਾ ਜੇਕਰ ਅਸੀਂ ਇਹ ਚਾਹੀਏ ਬੱਚਿਆਂ ਦੇ ਲਈ ਫਿੱਕਾ ਰੰਗ ਤਾਂ ਉਹ ਕਦੀ ਵੀ ਉਹ ਚੀਜ਼ ਬਣੀ ਹੋਈ ਵਧੀਆ ਨਹੀਂ ਲੱਗਦੀ ਹੈ